ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਮੈਂ ਇਸ ਦੇ ਉੱਪਰ ਮਤਲਬ ਰਿਕਾਰਡ ਬਣਾਇਆ ਹੋਇਆ ਆ ਪੰਜਾਬ ਦਾ ਜੋ ਵੀ ਯੋਗਦਾਨ ਹੈਗਾ ਆਪਣੇ ਭਾਰਤ ਨੂੰ ਭਾਰਤ ਦੀ ਅਰਥ ਵਿਵਸਥਾ ਨੂੰ ਉੱਚਾ ਚੁੱਕਣ ਦੇ ਲਈ ਸਭ ਤੋਂ ਪਹਿਲਾਂ ਤਾਂ ਮਤਲਬ ਐਗਰੀਕਲਚਰ ਏਰੀਆ ਜਿਹੜਾ ਪੰਜਾਬ ਦੇ ਵਿੱਚ ਖੇਤੀ ਬਹੁਤ ਕੀਤੀ ਜਾਂਦੀ ਆ ਹੈ ਨਾ ਕਿ ਜਿਸ ਤਰ੍ਹਾਂ ਮੇਨ ਫਸਲਾਂ ਜਿੱਦਾਂ ਵੀ ਕਣਕ ਚਾਵਲ ਜੋ ਵੀ ਮੇਨ ਭਾਰਤ ਦੇ ਲੋਕ ਜਿਹੜੇ ਉਹ ਖਾਂਦੇ ਆ ਜੋ ਚੀਜ਼ਾਂ ਉਹਦੀ ਪੈਦਾਵਾਰ ਪੰਜਾਬ ਦੇ ਵਿੱਚ ਦੂਜੇ ਰਾਜਾਂ ਨਾਲੋਂ ਜ਼ਿਆਦਾ ਏ ਅਤੇ ਮੇਨ ਪੁਆਇੰਟ ਪ ਪਹਿਲਾਂ ਇਹੀ ਹੈ ਕਿ ਐਗਰੀਕਲਚਰ ਦਾ ਜਿਹੜਾ ਜ਼ਿਆਦਾ ਸਰੋਤ ਆ ਪੰਜਾਬ ਦਾ ਜ਼ਿਆਦਾ ਯੋਗਦਾਨ ਆ ਉਸ ਤੋਂ ਬਾਅਦ ਜਿੱਦਾਂ ਕਈ ਸ਼ਹਿਰ ਜਿਹੜੇ ਆਪਣੇ ਲਗਾ ਲਓ ਕਿ ਵੱਡੇ ਸ਼ਹਿਰ ਜਿੱਦਾਂ ਲੁਧਿਆਣਾ ਹੋਇਆ ਜਾਂ ਹੋਰ ਬਠਿੰਡਾ ਵਗੈਰਾ ਜਾਂ ਅੰਮ੍ਰਿਤਸਰ ਦੇ ਵਿੱਚ ਵੇਖ ਲਓ ਇੰਡਸਟਰੀਅਲ ਏਰੀਆ ਜਿਹੜਾ ਕਿ ਉਹ ਬਹੁਤ ਜ਼ਿਆਦਾ ਆ ਜੋ ਵੀ ਇੰਡਸਟਰੀ ਦੇ ਵਿੱਚ ਸਮਾਨ ਬਣਦਾ ਆ ਉਹ ਆਪਣੇ ਭਾਰਤ ਤੋਂ ਵੀ ਲੈ ਕੇ ਮਤਲਬ ਕਿ ਇੰਟਰਨੈਸ਼ਨਲ ਵੀ ਐਕਸਪੋਰਟ ਕੀਤਾ ਜਾਂਦਾ ਆ ਉਹਦੇ ਵਿੱਚ ਆਪਾਂ ਨੂੰ ਹਾਂਜੀ ਥਰਮਲ ਪਲਾਂਟ ਦੇ ਵਿੱਚ ਜਿੱਦਾਂ ਇਲੈਕਟ੍ਰੀਸਿਟੀ ਆ ਉਹ ਵੀ ਮਤਲਬ ਕਿ ਭਾਰਤ ਦੇ ਵਿੱਚ ਬਣਦੀ ਆ ਅਤੇ ਉਹ ਵੀ ਆਪਣਾ ਇੱਕ ਵੱਡਾ ਯੋਗਦਾਨ ਹੈਗਾ ਆ ਹੋਰ ਵੀ ਛੋਟੀਆਂ ਮੋਟੀਆਂ ਬਹੁਤ ਹੀ ਇੰਡਸਟਰੀ ਹੈਗੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਏ ਜੀ ਓਕੇ